ਹੈਲੋ ਸਤਿ ਸ਼੍ਰੀ ਅਕਾਲ ਜੀ ਅ ਅਕਾਲ ਟਰੈਵਲਲ ਤੋਂ ਬੋਲਦੇ ਹੋ ਜੀ ਹਾਂਜੀ ਮੈਂ ਕੈਬ ਬੁੱਕ ਕੀਤੀ ਸੀ ਜੀ ਤੁਹਾਨੂੰ ਤੁਹਾਡਾ ਵੇਟ ਕਰ ਰਿਹਾ ਸੀ ਤੁਸੀਂ ਕਦੋਂ ਤੱਕ ਆਉਂਗੇ ਹਾਂਜੀ ਮੈਂ ਫੇਸ ਥਰੀ ਦੇ ਗੁਰਦੁਆਰੇ ਦੇ ਬਾਹਰ ਖੜ੍ਹਾ ਜੀ ਇਹ ਰੇਡੀਓ ਸਟੇਸ਼ਨ ਰੋਡ 'ਤੇ ਹੈ ਜੀ ਅਤੇ ਮੇਰੇ ਬਲੈਕ ਰੰਗ ਦੀ ਜੈਕਟ ਪਾਈ ਹੋਈ ਜੀ ਬਲੈਕ ਹੀ ਪੈਂਟ ਪਾਈ ਹੋਈ ਹੈ ਅਤੇ ਮੇਰੇ ਹੱਥ ਦੇ ਵਿੱਚ ਬਲੈਕ ਕਰਦਾ ਹੀ ਕਲਰ ਦਾ ਹੀ ਬੈਗ ਹੈ ਜੀ ਜੇ ਫਿਰ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਮੈਨੂੰ ਲੱਭਣ ਦੇ ਵਿੱਚ ਤੁਸੀਂ ਮੈਨੂੰ ਕੋਲ ਕਰ ਸਕਦੇ ਹੋ ਮੈਨੂੰ ਮੈਂ ਥੋੜ੍ਹਾ ਅਰਜੈਂਟ ਜਾਣਾ ਜੀ ਤੋ ਪਲੀਜ਼ ਥੋੜ੍ਹਾ ਛੇਤੀ ਪਹੁੰਚਣ ਦੀ ਕ੍ਰਿਪਾਲਤਾ ਕਰੋ ਜੀ ਧੰਨਵਾਦ